ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਵਿੰਦਰ ਸਿੰਘ ਹੈ ਜੀ ਮੇਰਾ ਇੱਕ ਫੂਡ ਵਲੌਗਰ ਚੈਨਲ ਹੈ ਜੀ ਯੂਟਿਊਬ 'ਤੇ ਜੀ ਹਾਂਜੀ ਸਰ ਮੈਂ ਇੱਕ ਵੀਡੀਓ ਬਣਾਉਣਾ ਚਾਹੁੰਦਾ ਜੀ ਠੀਕ ਹੈ ਜੀ ਵਲੋਗ ਬਣਾਉਣਾ ਚਾਹੁੰਦਾ ਜੀ ਇੱਕ ਪੰਜਾਬੀ ਫੂਡ 'ਤੇ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜ ਹਾਂਜੀ ਹਾਂਜੀ ਇੱਕ ਇੱਕ ਹੋਰ ਸੁਣਿਆ ਜੀ ਸਰ੍ਹੋਂ ਦੇ ਸਾਗ ਵਾਲਾ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਸਰ ਕੋਈ ਗੱਲ ਨਹੀਂ ਫਿਰ ਮੈਂ ਆਵਾਂਗਾ ਜੀ ਇੱਕ ਤਿੰਨ ਚਾਰ ਦਿਨ ਤੱਕ ਆਵਾਂਗਾ ਜੀ ਵਲੋਗ ਬਣਾਉਣ ਜੀ ਚਲੋ ਵਧੀਆ ਗੱਲ ਆ ਜੀ ਹਾਂਜੀ ਹਾਂਜੀ ਵਧੀਆ ਸਰ